ਸਮਾਜ ਵਿੱਚ ਡਾਂਸਰਾਂ ਦੇ ਪੇਸ਼ੇ ਨੂੰ ਬਹੁਤ ਵਧੀਆ ਨਹੀਂ ਸਮਝਿਆ ਜਾਂਦਾ ਇਸ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਗੀਤਾ ਕਪੂਰ ਜੋ ਕਿ ਹੁਣ ਬੋਲੀਵੁੱਡ ਦੇ ਵਿੱਚ ਇੱਕ ਮਸ਼ਹੂਰ ਕੋਰੀਓਗ੍ਰਾਫਰ ਹਨ ਉਹਨਾਂ ਨੇ ਵੀ ਆਪਣੇ ਡਾਂਸ ਦੇ ਜੀਵਨ ਵਿੱਚ ਬਹੁਤ ਮੁਸ਼ਕਿਲਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦਾ ਬਹੁਤ ਵਧੀਆ ਸਾਥ ਦਿੱਤਾ ਸਹਿਯੋਗ ਕੀਤਾ ਜਿਸ ਨਾਲ ਉਹ ਸਮਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਇਸ ਕਿੱਤੇ ਵਿੱਚ ਬਹੁਤ ਅੱਗੇ ਵਧੇ ਅਤੇ ਉਹਨਾਂ ਨੇ ਆਪਣਾ ਨਾਮ ਰੌਸ਼ਨ ਕੀਤਾ